ਮੇਰੇ ਘਰ ਵਿੱਚ ਬਿਜਲੀ ਕੁੱਲ ਮਿਲਾ ਕੇ ਬਾਰਾਂ ਸੋਲ੍ਹਾਂ ਘੰਟੇ ਆਉਂਦੀ ਹੈ ਪਰ ਵੱਖ ਵੱਖ ਮੌਸਮਾਂ ਦੇ ਦੌਰਾਨ ਬਿਜਲੀ ਦੇ ਕੱਟ ਹੋਣ ਦੀ ਸਮੱਸਿਆ ਵੱਧ ਜਾਂ ਘੱਟ ਹੁੰਦੀ ਹੈ ਗਰਮੀਆਂ ਵਿੱਚ ਜਦੋਂ ਤਾਪਮਾਨ ਬਹੁਤ ਵੱਧ ਜਾ ਜਾਂਦਾ ਹੈ ਤਾਂ ਬਿਜਲੀ ਜ਼ਿਆਦਾ ਘੱਟ ਹੋਣ ਲੱਗਦੀ ਹੈ ਇਸ ਨਾਲ ਏ ਸੀ ਅਤੇ ਪੱਖੇ ਨਹੀਂ ਚੱਲਦੇ ਜਿਸ ਨਾਲ ਗਰਮੀ ਵਿੱਚ ਸਹੂਲਤ ਨਹੀਂ ਮਿਲਦੀ ਅਤੇ ਸਿਹਤ 'ਤੇ ਅਸਰ ਪੈਂਦਾ ਹੈ ਸਰਦੀਆਂ ਵਿੱਚ ਬਿਜਲੀ ਦੇ ਕੱਟ ਕਾਫੀ ਘੱਟ ਜਾਂਦੇ ਹਨ ਪਰ ਜਦੋਂ ਮੀਂਹ ਜਾਂ ਤੂਫਾਨ ਆਉਂਦੇ ਹਨ ਤਾਂ ਬਿਜਲੀ ਚੱਲਣ ਦੀ ਸਮੱਸਿਆ ਹੋ ਸਕਦੀ ਹੈ ਜਿਸ ਨਾਲ ਘਰ ਦੀ ਸੁਵਿਧਾ ਅਤੇ ਖਾਣ ਪੀਣ ਦੇ ਸਮਾਨ 'ਤੇ ਅਸਰ ਪੈਂਦਾ ਹੈ ਜੇ ਬਿਜਲੀ ਦੀ ਆਵਾਜਾਈ ਨਿਅਮਤ ਹੋਵੇ ਤਾਂ ਇਹ ਜ਼ਿੰਦਗੀ ਦੇ ਹਰ ਅੰਸ਼ ਨੂੰ ਸੁਚੱਜਾ ਅਤੇ ਸੌਖਾ ਬਣਾਉਂਦੀ ਹੈ ਪਰ ਜਦੋਂ ਬਿਜਲੀ ਕੱਟ ਹੁੰਦਾ ਹੈ ਤਾਂ ਇਹ ਦਿਨਚਰਿਆ ਅਤੇ ਕੰਮ ਕਾਜ 'ਤੇ ਮਸਲਾ ਪੈਦਾ ਕਰਦਾ ਹੈ